ਜੀ ਹਾਂ ਮੈਂ ਸੋਚਦੀ ਹਾਂ ਕਿ ਯੋਗਾ ਵੱਖ ਵੱਖ ਉਮਰਾਂ ਯੋਗਤਾਵਾਂ ਅਤੇ ਪਿੱਛੋ ਪਿੱਛੋਕੜ ਵਾਲੇ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ ਜੇ ਆਪਾਂ ਦੇਖਿਆ ਜਾਵੇ ਤਾਂ ਜੇ ਕੋਈ ਛੋਟੀ ਉਮਰ ਤੋਂ ਹੀ ਯੋਗਾ ਕਰ ਰਿਹਾ ਤਾਂ ਉਹਨੂੰ ਉਸਦਾ ਬਹੁਤ ਜ਼ਿਆਦਾ ਲਾਭ ਮਿਲਦਾ ਹੈਗਾ ਉਹਦੇ ਕਦੇ ਵੀ ਜੋਆਇੰਟਸ ਪੇਨ ਨਹੀਂ ਹੁੰਦੇ ਉਹਦੇ ਕਦੇ ਗੋਡਿਆਂ 'ਚ ਕਦੇ ਕਿਤੇ ਵੀ ਕੋਈ ਦਰਦ ਨਹੀਂ ਹੁੰਦੀ ਅਤੇ ਉਹਨਾਂ ਨੂੰ ਉਸ ਚੀਜ਼ ਦਾ ਬਹੁਤ ਲਾਭ ਮਿਲਦਾ ਜੇ ਆਪਾਂ ਦੇਖਿਆ ਜਾਵੇ ਕੋਈ ਬਜ਼ੁਰਗਾਂ ਨੂੰ ਹੈਗਾ ਅਤੇ ਬਜ਼ੁਰਗਾਂ ਨੂੰ ਐਂ ਹੈਗਾ ਕਿ ਉਹਨਾਂ ਦੇ ਜੋੜਾਂ 'ਚ ਬਹੁਤ ਦਰਦ ਰਹਿੰਦਾ ਉਸ ਉਮਰ ਵਿੱਚ ਜਾ ਕੇ ਅਤੇ ਜੇ ਉਹ ਯੋਗਾ ਕਰਦੇ ਰਹਿਣ ਤਾਂ ਉਹਨਾਂ ਦੇ ਬੁਢਾਪੇ ਵਿੱਚ ਜਾ ਕੇ ਉਹਨਾਂ ਨੂੰ ਕਦੇ ਵੀ ਦਰਦਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਹਨੂੰ ਉਸ ਚੀਜ਼ ਦਾ ਬਹੁਤ ਲਾਭ ਮਿਲਦਾ ਹੁਣ ਜਿਸ ਤਰ੍ਹਾਂ ਨੌਜਵਾਨ ਦੇਖਿਆ ਜਾਵੇ ਕਈ ਸਪੋਰਟਸ ਵਿੱਚ ਜਾਂਦੇ ਆ ਕਈ ਜੇ ਉਹ ਨਿਰੰਤਰ ਯੋਗਾ ਕਰਦੇ ਆ ਅਤੇ ਉਹਨਾਂ ਦਾ ਸਟੈਮੀਨਾ ਬਹੁਤ ਜ਼ਿਆਦਾ ਹੀ ਵੱਧ ਜਾਂਦਾ ਹੈ ਅਤੇ ਉਹ ਕਿਸੇ ਵੀ ਸਪੋਰਟਸ ਵਿੱਚ ਬਹੁਤ ਜਲਦੀ ਥੱਕਦੇ ਨਹੀਂ ਆ ਅਤੇ ਉਹਨਾਂ ਦਾ ਸਰੀਰ ਉੰਨਾ ਹੀ ਫਿਟ ਅਤੇ ਤੰਦਰੁਸਤ ਹੋ ਜਾਂਦਾ ਹੈ ਬਿਕੋਜ਼ ਇਹ ਯੋਗਾ ਬਹੁਤ ਜ਼ਿਆਦਾ ਫ਼ਾਇਦੇ ਦਿੰਦਾ ਅਤੇ ਉਹਦੇ ਨਾਲ ਇੱਕ ਵੱਖਰੇ ਵੱਖਰੇ ਉਮਰ 'ਤੇ ਵੱਖਰੇ ਵੱਖਰੇ ਪੜਾਵ ਅਤੇ ਬਹੁਤ ਜ਼ਿਆਦਾ ਲਾਈਵ ਲਾਭਦਾਇਕ ਹੈ ਜੋ ਸ਼ੁਰੂ ਤੋਂ ਕਰ ਰਿਹਾ ਉਸ ਨੂੰ ਬਹੁਤ ਜ਼ਿਆਦਾ ਕਿਸੇ ਨੇ ਬਾਅਦ ਚੋਂ ਸ਼ੁਰੂ ਕੀਤਾ ਹੈ ਜੇ ਕੋਈ ਬੰਦਾ ਸ਼ੁਰੂ ਤੋਂ ਕਰ ਰਿਹਾ ਉਹਨੂੰ ਛੋਟੀ ਉਮਰ 'ਚ ਵੀ ਲਾਭ ਹੈ ਉਹਨੂੰ ਨੌਜਵਾਨੀ 'ਚ ਉਹਦੀ ਮਤਲਬ ਕਿ ਸਾਰੀ ਉਮਰ ਹੀ ਬਹੁਤ ਵਧੀਆ ਨਿਕਲਦੀ ਹੈ ਬਿਕੋਜ਼ ਯੋਗਾ ਨੇ ਉਹਨਾਂ ਦੇ ਸਰੀਰ ਨੂੰ ਇੰਨਾ ਕਿ ਤੰਦਰੁਸਤ ਬਣਾ ਦਿੱਤਾ ਜਾਂਦਾ ਜਿਹੜਾ ਉਹਨੂੰ ਬਹੁਤ ਜ਼ਿਆਦਾ ਲਾਭ ਦਿੰਦਾ